ਮੈਂ ਟਿਟਲਿਸ ਬ੍ਰੈਂਡ ਦੀ ਇੱਕ ਚਾਦਰ ਲਈ ਜੋ ਕਿ ਸਰਦੀਆਂ ਦੀ ਰੁੱਤ ਲਈ ਲਈ ਸੀਗੀ ਚਾਦਰ ਬਹੁਤ ਸੋਹਣੀ ਭੂਰੇ ਰੰਗ ਦੀ ਸੀਗੀ ਅਤੇ ਮੌਸਮ ਦੇ ਅਨੁਸਾਰ ਸਰਦ ਰੁੱਤ ਲਈ ਲਈ ਸੀ ਤਾਂ ਗਰਮ ਵੀ ਬਹੁਤ ਸੀਗੀ ਸਾਈਜ਼ ਦੇ ਪੱਖੋਂ ਵੀ ਬਹੁਤ ਵਧੀਆ ਸੀਗੀ ਜਿਵੇਂ ਕਿ ਡਬਲ ਬੈੱਡ ਦੇ ਲਈ ਲਈ ਗਈ ਸੀਗੀ ਉਹਦੇ ਉੱਤੇ ਬਹੁਤ ਖੁੱਲ੍ਹੀ ਡੁੱਲੀ ਆਈ ਚਾਦਰ ਦੇ ਨਾਲ਼ ਦੋ ਸਿਰਹਾਣੇ ਮਿਲੇ ਅਤੇ ਦੋ ਕੁਸ਼ਨ ਕਵਰ ਵੀ ਮੈਨੂੰ ਮਿਲੇ ਚਾਦਰ ਦਾ ਰੰਗ ਭੂਰਾ ਸੀਗਾ ਅਤੇ ਜੋ ਵੀ ਬਾਕੀ ਦਾ ਕਮਰੇ ਦਾ ਫਰਨੀਚਰ ਸੀਗਾ ਉਹ ਉਹਦੇ ਨਾਲ਼ ਹੋਰ ਵੀ ਫੱਬਣ ਲੱਗ ਗਿਆ ਅਤੇ ਚਾਦਰ ਦੇ ਉੱਤੇ ਮੈਨੂੰ ਡਿਸਕਾਊਂਟ ਮਿਲਿਆ ਜੋ ਕਿ ਪਹਿਲਾਂ ਤਿੰਨ ਹਜ਼ਾਰ ਰੁਪਏ ਦੀ ਸੀਗੀ ਨਵੇਂ ਸਾਲ ਕਰਕੇ ਮੈਨੂੰ ਉਹ ਡਿਸਕਾਊਂਟ ਦੇ ਉੱਤੇ ਸਿਰਫ਼ ਪੱਚੀ ਸੌ ਰੁਪਏ ਦੀ ਮਿਲੀ ਅਤੇ ਚਾਦਰ ਨੂੰ ਰੱਖਣ ਦੇ ਲਈ ਅਲੱਗ ਤੋਂ ਇੱਕ ਬਹੁਤ ਵਧੀਆ ਬੈਗ ਮਿਲਿਆ ਜੋ ਕਿ ਬਹੁਤ ਲੰਬੇ ਸਮੇਂ ਤੱਕ ਚੱਲ ਸਕਦਾ ਹੈ ਅਤੇ ਚਾਦਰ ਨੂੰ ਲੰਮੇ ਸਮੇਂ ਤੱਕ ਆਪਾਂ ਜੇ ਬਾਅਦ ਵਿੱਚ ਗਰਮ ਰੁੱਤ ਦੇ ਵਿੱਚ ਢੱਕ ਕੇ ਰੱਖਣਾ ਹੈ ਉਹਦੇ ਵਾਸਤੇ ਵੀ ਉਹ ਬੈਗ ਹੈ ਜਿਹੜਾ ਕੰਮ ਆਵੇਗਾ